ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਮਿਡਡੇ ਮੀਲ ਸਕੀਮ ਬਾਰੇ ਜਾਣਦੀ ਹਾਂ ਕਿਉਂਕਿ ਮੈਂ ਈ ਟੀ ਟੀ ਅਤੇ ਬੀ ਐਡ ਦੀ ਸਟੂਡੈਂਟ ਹਾਂ ਔਰ ਮੈਂ ਸਕੂਲਾਂ ਵਿੱਚ ਰਹੀ ਹੋਈ ਹਾਂ ਅਤੇ ਇਹ ਸਕੀਮ ਦੀ ਦੌਰਾਨ ਮੈਂ ਪੀ ਪੀ ਦੌਰਾਨ ਇਹ ਸਕੀਮ ਵਿੱਚ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਤਾਂ ਮੈਨੂੰ ਇਹ ਸਕੀਮ ਬਹੁਤ ਵਧੀਆ ਲੱਗਦੀ ਆ ਮੇਰੇ ਅਨੁਸਾਰ ਇਹ ਬਹੁਤ ਵਧੀਆ ਸਕੀਮ ਆ ਇਸ ਵਿੱਚ ਪਹਿਲੀ ਤੋਂ ਪਹਿਲਾਂ ਤਾਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਤਾਂ ਫਿਰ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਦੇ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਇਸ ਨਾਲ ਸਕੂਲਾਂ ਦੀ ਗ੍ਰੋਥ ਵਧੀ ਆ ਕਿਉਂਕਿ ਆਪਣੇ ਜਿਹੜੇ ਪੰਜਾਬ ਆਪਾਂ ਨੂੰ ਪੂਰੇ ਭਾਰਤ 'ਚ ਹੀ ਗਰੀਬੀ ਬਹੁਤ ਹੇਠਾਂ ਦੇ ਲੋਕ ਰਹਿੰਦੇ ਆ ਜਿਹਨਾਂ ਨੂੰ ਖਾਣਾ ਪ੍ਰੋਪਰ ਨਹੀਂ ਮਿਲਦਾ ਬੱਚੇ ਭੁੱਖੇ ਹੁੰਦੇ ਆ ਅਤੇ ਉਹ ਸਕੂਲ 'ਚ ਖਾਣਾ ਖਾਣ ਲਈ ਹੈ ਨਾ ਸਪੈਸ਼ਲੀ ਆਉਂਦੇ ਅਤੇ ਬੱਚੇ ਸਕੂਲ ਲਈ ਆਉਂਦੇ ਆ ਅਤੇ ਇਹਨਾਂ ਨਾਲ ਉਹਨਾਂ ਦੀ ਸਿੱਖਿਆ ਵੀ ਹੁੰਦੀ ਅਤੇ ਉਹ ਬੱਚੇ ਖਾਣਾ ਵੀ ਖਾਂਦੇ ਆ ਫਿਰ ਸੈਕਿੰਡ ਗੱਲ ਵੀ ਉਹ ਪ੍ਰੋਟੀਨ ਦੇ ਸ਼ਿਕਾਰ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਸਾਰਾ ਪੋਸ਼ਕ ਤੱਤ ਜਿਹੜੇ ਹੈਗੇ ਮਿਲਦੇ ਆ ਵੀ ਇਹ ਮਿਡਡੇ ਮੀਲ 'ਚ ਸਾਰੇ ਜਿਹੜਾ ਹੈ ਨਾ ਡੇਲੀ ਰੂਟੀਨ ਬਣਦਾ ਕਿਹੜੀ ਕਿਹੜੀ ਸਬਜ਼ੀ ਬਣਨੀ ਹੈ ਕਿ ਖਾਣਾ ਖੀਰ ਬਣਦੀ ਆ ਫ਼ਲ ਦਿੱਤੇ ਜਾਂਦੇ ਆ ਬੱਚਿਆਂ ਨੂੰ ਪਨੀਰ ਦੀ ਸਬਜ਼ੀ ਬਣਦੀ ਆ ਅਤੇ ਜਿਵੇਂ ਜੋ ਚੀਜ਼ਾਂ ਬੱਚਿਆਂ ਲਈ ਸਰੀਰ ਲਈ ਬਹੁਤ ਜ਼ਰੂਰੀ ਆ ਹੈ ਨਾ ਉਹ ਸਾਰੇ ਸਾਰੀਆਂ ਸਾਰੀਆਂ ਸਬਜ਼ੀਆਂ ਵੀ ਮਿਡਡੇ ਮੀਲ 'ਚ ਬਣਾਈਆਂ ਜਾਂਦੀਆਂ ਅਤੇ ਫਿਰ ਸਪੈਸ਼ਲੀ ਟੀਚਰਾਂ ਦੀ ਡਿਊਟੀ ਲੱਗਦੀ ਹੈ ਵੀ ਜਿਹੜੇ ਟੀਚਰ ਆ ਉਹ ਖਾਣਾ ਖਾ ਕੇ ਦੇਖਦੇ ਆ ਵੀ ਇਹ ਖਾਣਾ ਵਧੀਆ ਬੱਚਿਆਂ ਦੇ ਖਾਣ ਯੋਗ ਆ ਫਿਰ ਜਿਹੜੇ ਮਤਲਬ ਬੱਚਿਆਂ ਦੇ ਜਿਹੜੇ ਮਾਂ ਪਿਓ ਮਜ਼ਦੂਰੀ ਕਰਦੇ ਹੈ ਟੀਫਨ ਨਹੀਂ ਪੈਕ ਕਰ ਸਕਦੇ ਉਹਨਾਂ ਲਈ ਸਭ ਤੋਂ ਵਧੀਆ ਵੀ ਬੱਚਿਆਂ ਨੂੰ ਇੱਥੇ ਪ੍ਰੋਪਰ ਖਾਣਾ ਮਿਲਦਾ ਫਿਰ ਠੰਡ ਬਹੁਤ ਹੁੰਦੀ ਹੈ ਖਾਣਾ ਠੰਡਾ ਹੁੰਦਾ ਉਹ ਖਾਣਾ ਬਹੁਤਾ ਔਖਾ ਹੁੰਦਾ ਔਰ ਇਸ ਵਿੱਚ ਬੱਚੇ ਜਿਹੜੇ ਗਰਮ ਖਾਣਾ ਵੀ ਖਾਂਦੇ ਆ ਹੈ ਨਾ ਤਾਜ਼ਾ ਬਣਿਆ ਖਾਣਾ ਖਾਂਦੇ ਆ ਅਤੇ ਜਿਹੜੇ ਬੱਚਿਆਂ ਦਾ ਜਿਹੜਾ ਪੋਸ਼ ਪੋਸ਼ਨ ਕੁਪੋਸ਼ਣ ਨਹੀਂ ਹੁੰਦਾ ਪੌਸ਼ਟਿਕ ਰਹਿੰਦੇ ਆ ਸਾਰੇ ਤੰਦਰੁਸਤ ਰਹਿੰਦੇ ਆ ਤਾਂ ਮੈਨੂੰ ਇਹ ਮਿਡਡੇ ਮੀਲ ਸਕੀਮ ਬਹੁਤ ਵਧੀਆ ਲੱਗਦੀ ਆ ਇਹ ਕਾਮਯਾਬ ਸਕੀਮ ਹੈਗੀ ਆ ਥੈਂਕ ਯੂ